ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਮਿਲਜੇਗਾ ਕਿੱਦਾਂ ਦਾ ਚਾਹੀਦਾ ਤੁਹਾਨੂੰ ਹੋਮ ਹਾਂਜੀ ਹਾਂਜੀ ਖਰੜ 'ਚ ਆਪਾਂ ਡੀਲਿੰਗ ਕਰਦੇ ਹਾਊਸ ਲਈ ਮੋਹਾਲੀ ਖਰੜ ਮੋਹਾਲੀ ਹਾਂਜੀ ਹਾਂਜੀ ਪ੍ਰਾਈਜ਼ ਜੀ ਅ ਲੋਕੇਸ਼ਨ 'ਤੇ ਡਿਪੈਂਡ ਕਰਦਾ ਕਿੱਦਾਂ ਦੀ ਵਧੀਆ ਲੋਕੇਸ਼ਨ ਚਾਹੀਦੀ ਕਿਵੇਂ ਦੀ ਕਲੋਨੀ ਚਾਹੀਦੀ ਅੱਛਾ ਅਤੇ ਮਿਲ ਜੇਗਾ ਤਾਂ ਤੁਹਾਨੂੰ ਮਤਲਬ ਫਲੈਟ ਟਾਈਪ ਚਾਹੀਦਾ ਮਤਲਬ ਜਾਂ ਕਿ ਕੋਠੀ ਬਣਾਉਣੀ ਆ ਤੁਸੀਂ ਆਪ ਪਲੋਟ ਲੈ ਕੇ ਆਪ ਖੜ੍ਹਾ ਕਰਨਾ ਕੋਠੀ ਚਾਹੀਦੀ ਕਿ ਤੁਹਾਨੂੰ ਫਲੈਟ ਚਾਹੀਦਾ ਅਪਾਰਟਮੈਂਟ ਅੱਛਾ ਜੀ ਮਿਲ ਜੇਗਾ ਜੀ ਬਹੁਤ ਅਪਾਰਟਮੈਂਟ ਬਣੇ ਹੋਏ ਨੇ ਮੋਹਾਲੀ 'ਚ ਖਰੜ 'ਚ ਫਸੀਲਿਟੀ ਜੀ ਆਪਾਂ ਨੂੰ ਜਿਵੇਂ ਥਰੀ ਬੀ ਐਚ ਕੇ ਤੁਹਾਡੀ ਡਿਮਾਂਡ ਹੈ ਥਰੀ ਬੀ ਐਚ ਕੇ ਜੇ ਤਿੰਨਾਂ 'ਚ ਬੈੱਡ ਆ ਬੈਡਰੂਮ ਨਾਲ਼ ਅਟੈਚ ਬਾਥਰੂਮ ਮਿਲਜੂਗਾ ਹੋਲ ਮਿਲਜੂਗਾ ਵਿੱਚ ਫੁੱਲ ਫਰਨਿਸ਼ਡ ਥੋਨੂੰ ਫਰਨੀਚਰ ਮਿਲਜੇਗਾ ਸਾਰਾ ਕੁਝ ਮੰਨ ਲਉ ਤੁਸੀਂ ਕੰਪਲੀਟ ਤਿਆਰ ਹੋਊਗਾ ਹਾਂਜੀ ਵੋਟਰ ਸਪਲਾਈ ਸਾਡੇ ਖੁਦ ਦੇ ਬੋਰ ਹੁੰਦੇ ਕਰਵਾਏ ਹੋਏ ਵਧੀਆ ਸੁਸਾਇਟੀਆਂ ਦੇ ਆਪਣੇ ਸਵੰਸੀਬਲ ਬੋਰ ਹੈ ਸਾਰਾ ਪਾਣੀ ਮਤਲਬ ਵਧੀਆ ਚੌਵੀਂ ਘੰਟੇ ਫੈਸਿਲਿਟੀ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹੋਰ ਟਵੰਟੀ ਫੋਰ ਆਰ ਹੈ ਜੀ ਹਾਂ ਪ੍ਰਾਈਜ਼ ਤੁਸੀਂ ਮੰਨ ਲਓ ਵਧੀਆ ਤੁਸੀਂ ਹਿਸਾਬ ਲਾ ਲਓ ਵੀ ਪੈਂਤੀ ਅਠੱਤੀ ਪੈਂਤੀ ਅਠੱਤੀ ਲੱਖ ਤੋਂ ਸ਼ੁਰੂ ਹੋ ਕੇ ਉੱਪਰ ਉੱਪਰ ਨੂੰ ਜਾ ਰਿਹਾ ਵੀ ਥੱਲੇ ਨੂੰ ਨਹੀਂ ਆਉਂਦੇ ਅਤੇ ਉੱਪਰ ਹੀ ਜਾਊਗਾ ਥੱਲੇ ਨੂੰ ਨਹੀਂ ਆਉਂਦਾ ਕੰਮ ਠੀਕ ਆ ਓਕੇ ਓਕੇ ਮੈਂ ਕਰ ਦਿੰਦਾ ਤੁਹਾਨੂੰ ਵਟਸਐੱਪ ਕਰ ਦਿੰਦਾ